ਇਹ ਗੱਲ ਸੱਚ ਹੈ ਕਿ ਭਾਰਤ ਵਿੱਚ ਕਲਾਕਾਰਾਂ ਨੂੰ ਲੋੜੀਂਦੀ ਮਹੱਤਤਾ ਅਤੇ ਮੌਕੇ ਨਹੀਂ ਮਿਲਦੇ ਕਿਉਂਕਿ ਅੱਜ ਕੱਲ੍ਹ ਜਿਵੇਂ ਇੰਡਸਟਰੀ ਵਧ ਰਹੀ ਹੈ ਤਾਂ ਉੱਧਰ ਲੋਕਾਂ ਦਾ ਧਿਆਨ ਜ਼ਿਆਦਾ ਹੋ ਗਿਆ ਹੈ ਅਤੇ ਜਿਵੇਂ ਕਲਾਕਾਰ ਲਿਖਣ ਵਾਲੇ ਹੋ ਗਏ ਅਤੇ ਡਰੋਇੰਗ ਵਾਲੇ ਉਹਨਾਂ ਦਾ ਤਾਂ ਕੋਈ ਨਾਮ ਵੀ ਨਹੀਂ ਜਾਣਦਾ ਜਿਸ ਕਰਕੇ ਉਹਨਾਂ ਦੀ ਕੋਈ ਚਰਚਾ ਨਹੀਂ ਹੁੰਦੀ ਸਿਰਫ ਉਹਨਾਂ ਨੂੰ ਹੀ ਪਤਾ ਹੁੰਦਾ ਹੈ ਜੋ ਇਸ ਫੀਲਡ ਵੱਲ ਹੁੰਦੇ ਹਨ ਅਤੇ ਇਸ ਕਰਕੇ ਉਹਨਾਂ ਦੀ ਜੋ ਕਲਾ ਹੈ ਉਹ ਕੁਝ ਕੁ ਟਮੇ ਸਮੇਂ ਵਿੱਚ ਹੀ ਖਤਮ ਹੋ ਜਾਂਦੀ ਹੈ ਅਤੇ ਉਹਨਾਂ ਨੂੰ ਇੰਨੇ ਪੈਸੇ ਵੀ ਨਹੀਂ ਮਿਲਦੇ ਤਾਂ ਜੋ ਆਪਣਾ ਘਰ ਦਾ ਗੁਜ਼ਾਰਾ ਸਾਰ ਸਕਣ ਅਤੇ ਜਿਸ ਕਰਕੇ ਉਹਨਾਂ ਨੂੰ ਫਿਰ ਦੂਸਰੇ ਕੰਮਾਂ 'ਤੇ ਲੱਗਣਾ ਪੈ ਜਾਂਦਾ ਹੈ ਜਿਸ ਕਰਕੇ ਉਹਨਾਂ ਦੀਆਂ ਕਲਾ ਜੋ ਕਲਾ ਨੇ ਉਹ ਖਤਮ ਹੋ ਰਹੀਆਂ ਹਨ ਦਿਨੋਂ ਦਿਨ ਅਤੇ ਸਾਨੂੰ ਚਾਹੀਦਾ ਹੈ ਕਿ ਅਸੀਂ ਉਹਨਾਂ ਦੀ ਕਦਰ ਕਰੀਏ ਤਾਂ ਜੋ ਉਹਨਾਂ ਨੂੁੰ ਵੀ ਦੂਸਰੇ ਲੋਕ ਵੀ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਉਹ ਕੰਮ ਕਰਨ